ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਕਿਰਨਜੋਤ ਹੈ ਮੈਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਵਿੱਚ ਪੜ੍ਹਦੀ ਹਾਂ ਇੱਥੇ ਅਕਸਰ ਹੀ ਕਲਾ ਦੇ ਪ੍ਰਦਰਸ਼ਨੀ ਦੇ ਮੇਲੇ ਲੱਗਦੇ ਰਹਿੰਦੇ ਹਨ ਜਿਹਦੇ ਵਿੱਚ ਕਿ ਪੰਜਾਬੀ ਲੋਕ ਕਲਾਵਾਂ ਦੀ ਜ਼ਿਆਦਾਤਰ ਜੋ ਕਲਾ ਪ੍ਰਦਰਸ਼ਨੀਆਂ ਹੁੰਦੀ ਹੈ ਇਸ ਤੋਂ ਇਲਾਵਾ ਮੈਂ ਕਿਉਂਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੇਟਾਂ ਦੇ ਲੋਕ ਇੱਥੇ ਰਹਿੰਦੇ ਨੇ ਅਤੇ ਇੱਥੇ ਕਈ ਵਾਰ ਇਹ ਵਾਲੇ ਮੇਲੇ ਵੀ ਓਰਗਨਾਈਜ਼ ਕੀਤੇ ਜਾਂਦੇ ਹਨ ਜਿਹਨਾਂ ਦੇ ਵਿੱਚ ਵੱਖ ਵੱਖ ਸਟੇਟਾਂ ਦੇ ਬੱਚੇ ਆ ਜਿਹੜੇ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਇਸ ਤੋਂ ਇਲਾਵਾ ਕੁਛ ਬਾਹਰੋਂ ਵੀ ਲੋਕ ਬੁਲਾਏ ਜਾਂਦੇ ਹਨ ਜਿਹਨਾਂ ਨੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਬਾਰੇ ਇੱਥੋਂ ਦੇ ਬੱਚਿਆਂ ਨੂੰ ਜਾਗਰਿਤ ਕੀਤਾ ਜਾਂਦਾ ਉਹਦੇ ਵਿੱਚ ਪੰਜਾਬੀ ਲੋਕ ਕਲਾਵਾਂ ਜਿਵੇਂ ਕਿ ਮੰਜਾ ਬੁਣਨਾ ਸਵੈਟਰਾਂ ਬੁਣਨੀਆਂ ਕੋਟੀਆਂ ਜਾਂ ਗੁੱਡੀਆਂ ਬਣਾਉਣੀਆਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਸ ਤਰ੍ਹਾਂ ਦੇ ਮੇਲੇ ਇੱਥੇ ਲੱਗੇ ਹਨ ਅਤੇ ਮੈਂ ਸਿਰਫ ਬਸ ਉਹਨਾਂ ਦੌਰਿਆਂ ਦੇ ਵਿੱਚ ਹੀ ਐਕਸਪੋਜ਼ਰ ਕੀਤਾ ਹੈ ਧੰਨਵਾਦ